ਜੀ ਬਿਲਕੁਲ ਯੋਗ ਦਾ ਅਭਿਆਸ ਜਿਹੜਾ ਹੈ ਤੁਹਾਡੀ ਮਾਨਸਿਕ ਅਤੇ ਸਰੀਰਿਕ ਦੋਵੇਂ ਸਿਹਤ ਦਾ ਖਜ਼ਾਨਾ ਹੈ ਜਿੱਥੇ ਮਨ ਨੂੰ ਤੁਸੀਂ ਆਰਾਮ ਮਹਿਸੂਸ ਕਰਦੇ ਹੋ ਸਰੀਰ ਦੇ ਵਿੱਚ ਵੀ ਤਾਜ਼ਗੀ ਅਨੁਭਵ ਕਰਦੇ ਹੋ ਰੋਜ਼ਾਨਾ ਜੀਵਨ ਦੇ ਵਿੱਚ ਜਿਹੜਾ ਹੈ ਇੱਕ ਵਧੀਆ ਪ੍ਰਭਾਵ ਮੈਡੀਟੇਸ਼ਨ ਦਾ ਪੈਂਦਾ ਹੈ ਕਿ ਧਿਆਨ ਨਾਲ ਜੇਕਰ ਤੁਸੀਂ ਪੰਜ ਮਿੰਟ ਵੀ ਇਕਾਗਰ ਚਿਤ ਹੋ ਕੇ ਬੈਠਦੇ ਹੋ ਤਾਂ ਤੁਹਾਡੇ ਦਿਮਾਗ ਦੀਆਂ ਬਹੁਤ ਸਾਰੀਆਂ ਇੰਦਰੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਸ਼ਕਤੀ ਅਤੇ ਸਮਰਥਾ ਪ੍ਰਦਾਨ ਕਰਦੀਆਂ ਨੇ ਅਤੇ ਸਰੀਰਕ ਥੋੜ੍ਹੀ ਥੋੜ੍ਹੀ ਕਸਰਤ ਥੋੜ੍ਹਾ ਥੋੜ੍ਹਾ ਯੋਗਾ ਮਤਲਬ ਬਹੁਤ ਤਾਂ ਹੈਵੀ ਜਿਹੜਾ ਯੋਗਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਮੈਂ ਨਹੀਂ ਕਰਦੀ ਪਰ ਹਲਕੀ ਫੁਲਕੀ ਕਸਰਤ ਹਲਕੇ ਫੁਲਕੇ ਯੋਗਾ ਆਸਨ ਜਿਹੜੇ ਨੇ ਕਿਉਂਕਿ ਅਸੀਂ ਬੱਚਿਆਂ ਨੂੰ ਵੀ ਸਿਖਾਉਂਦੇ ਹਾਂ ਅਤੇ ਖੁਦ ਵੀ ਕਰਦੇ ਹਾਂ ਤਾਂ ਉਹਨਾਂ ਨਾਲ ਬੜਾ ਅੱਛਾ ਬੜਾ ਰਿਲੈਕਸ ਜਿਹੜਾ ਮਹਿਸੂਸ ਹੁੰਦਾ ਸਵੇਰ ਦੇ ਸਮੇਂ ਹਲਕੀ ਕਸਰਤ ਕਰਨੀ ਉਹਦੇ ਨਾਲ ਸਰੀਰ ਜਿਹੜਾ ਫਰੈਸ਼ ਮਹਿਸੂਸ ਕਰਦਾ ਸਰੀਰ ਨੂੰ ਲੱਗਦਾ ਕਿ ਕੋਈ ਐਨਰਜੀ ਜਿਹੜੀ ਹੈ ਕੋਈ ਊਰਜਾ ਜਿਹੜੀ ਹੈ ਉਹ ਉਹ ਸਰੀਰ ਨੂੰ ਮਿਲੀ ਹੈ ਕਿਉਂਕਿ ਜਦੋਂ ਵੀ ਸਾਡਾ ਸਰੀਰ ਹਰਕਤ 'ਚ ਰਹਿੰਦਾ ਤਾਂ ਇਹ ਜਿਹੜਾ ਸਰੀਰ ਹੈ ਉਨੀ ਦੇਰ ਕਾਮਯਾਬ ਹੈ ਜਿੰਨੀ ਦੇਰ ਹਰਕਤ 'ਚ ਹੈ ਤਾਂ ਯੋਗਾ ਜਾਂ ਕਸਰਤ ਜਿਹੜੀ ਹੈ ਸਾਨੂੰ ਇੱਕ ਹਰਕਤ ਸਿਖਾਉਂਦੀ ਹੈ ਆਪਦੀ ਬੋਡੀ ਦੇ ਅੰਦਰ ਪੈਦਾ ਕਰਨੀ ਸੋ ਇੱਕ ਖਜ਼ਾਨਾ ਹੈ ਯੋਗ ਦਾ ਅਭਿਆਸ ਕਰਨਾ ਅਤੇ ਸਾਨੂੰ ਹਮੇਸ਼ਾ ਕਰਨਾ ਵੀ ਚਾਹੀਦਾ ਹੈ